ਪੋਲਟਰੀ ਦੀਆਂ ਕੁਝ ਆਮ ਕਿਸਮਾਂ ਜੋ ਖੇਤੀ ਅਤੇ ਬੈਕਯਾਰਡ ਸੈਟਿੰਗਾਂ ਵਿੱਚ ਉਗਾਈਆਂ ਜਾਂ ਪਾਲੀਆਂ ਜਾਂਦੀਆਂ ਹਨ ਦੇਸੀ ਮੁਰਗੀਆਂ ਇਹ ਆਮ ਤੌਰ 'ਤੇ ਪਿੰਡਾਂ ਵਿੱਚ ਪਾਈਆਂ ਜਾਂਦੀਆਂ ਹਨ ਅਤੇ ਸਹੀ ਮਾਇਨੇ ਵਿੱਚ ਮਿੱਟੀ ਅਤੇ ਮਿੱਟੀ ਅਤੇ ਘਰ ਦੇ ਬਚੇ ਖੁਚੇ ਕਣ ਨਾਲ ਪਾਲੀਆਂ ਜਾਂਦੀਆਂ ਹਨ ਸਾਰੇ ਬੋਏ ਬੋਇਲਰ ਮੁਰਗੀਆਂ ਇਹ ਮੁਰਗੀਆਂ ਖਾਸ ਇਹ ਮੁਰਗੀਆਂ ਮਾਸ ਲਈ ਪਾਲੀਆਂ ਜਾਂਦੀਆਂ ਨੇ ਇਹ ਵੱਡੇ ਪੈਮਾਨੇ 'ਤੇ ਵੀ ਅਤੇ ਘਰੇਲੂ ਪੱਧਰ 'ਤੇ ਵੀ ਪਾਈਆਂ ਜਾਂਦੀਆਂ ਹਨ ਲੇਅਰ ਮੁਰਗੀਆਂ ਇਹ ਮੁਰਗੀਆਂ ਅੰਡਿਆਂ ਲਈ ਪਾਲੀਆਂ ਜਾਂਦੀਆਂ ਨੇ ਇਹ ਬੈਕਯਾਰਡ ਸੈਟਿੰਗ ਵਿੱਚ ਅੰਡੇ ਪ੍ਰਦਾਨ ਕਰਨ ਲਈ ਬਹੁਤ ਮਸ਼ਹੂਰ ਹਨ ਬੈਟਮ ਮੁਰਗੀਆਂ ਇਹ ਛੋਟੀਆਂ ਮੁਰਗੀਆਂ ਹੁੰਦੀਆਂ ਹਨ ਇਹਨਾਂ ਨੂੰ ਕਈ ਵਾਰ ਸਿਰਫ ਪਾਲਤੂ ਜਾਂ ਸ਼ੌਕ ਨਾਲ ਪਾਲਿਆ ਜਾਂਦਾ ਹੈ ਅੰਗੂਰੀ ਮੁਰਗੀਆਂ ਇਹ ਇੱਕ ਪ੍ਰਸਿੱਧ ਕਿਸਮ ਹੈ ਜੋ ਮਾਸ ਅਤੇ ਅੰਡਿਆਂ ਲਈ ਉਗਾਈ ਜਾਂਦੀ ਹੈ ਇਹ ਬੈਕਯਾਰਡ ਸੈਟਿੰਗ ਵਿੱਚ ਅਸਾਨੀ ਨਾਲ ਪਾਲੀ ਜਾਂਦੀ ਹੈ ਔਰ ਕਿੰਗਟਨ ਇਹ ਮੁਰਗੀਆਂ ਦੁਹਰੀ ਉਦੇਸ਼ ਵਾਲੀਆਂ ਹੁੰਦੀਆਂ ਹਨ ਮਾਸ ਅਤੇ ਅੰਡੇ ਅਤੇ ਬੈਕਯਾਰਡ ਸੈਟਿੰਗ ਵਿੱਚ ਬਹੁਤ ਮਸ਼ਹੂਰ ਹਨ ਦੇਸੀ ਮੁਰਗੀਆਂ ਇਹ ਮੁਰਗੀਆਂ ਘਰ ਦੇ ਆਲੇ ਦੁਆਲੇ ਬਹੁਤ ਅਸਾਨੀ ਨਾਲ ਪਾਲੀਆਂ ਜਾਂਦੀਆਂ ਹਨ ਅਤੇ ਖਰਚਾ ਵੀ ਘੱਟ ਹੁੰਦਾ ਹੈ ਬੋਆਇਲਰ ਮੁਰਗੀਆਂ ਇਹ ਮਾਸ ਲਈ ਪਾਲੀਆ ਜਾਂਦੀਆਂ ਨੇ ਅਤੇ ਹਫਤੇ ਵਿੱਚ ਹੀ ਮਾਸ ਦੇਣ ਲੱਗਦੀਆਂ ਹਨ ਲੇਅਰ ਮੁਰਗੀਆਂ ਇਹ ਅੰਡਿਆਂ ਲਈ ਪਾਲੀਆਂ ਜਾਂਦੀਆਂ ਹਨ ਅਤੇ ਨਿੱਤ ਰੋਜ਼ ਅੰਡੇ ਦੇਣ ਵਾਲੀਆਂ ਹੁੰਦੀਆਂ ਹਨ ਆਪਣੇ ਕਾਰੋਬਾਰ ਦੇ ਪ੍ਰਬੰਧ ਖਾਣ ਪਾਣ ਦੀ ਸੰਭਾਲ ਮੈਂ ਮੁਰਗੀਆਂ ਨੂੰ ਗੁਣਵੱਤਾ ਵਾਲਾ ਖਾਣਾ ਪ੍ਰਦਾਨ ਕਰਦਾ ਹਾਂ ਜੋ ਉਹਨਾਂ ਦੀ ਸਿਹਤ ਅਤੇ ਉਤਪਾਦਕਾਂ ਨੂੰ ਵਧਾਉਂਦਾ ਹੈ ਇਸ ਵਿੱਚ ਦਾਣੇ ਹਰੇ ਚਾਰੇ ਅਤੇ ਪਾਣੀ ਸ਼ਾਮਿਲ ਹੁੰਦਾ ਹੈ ਸਫਾਈ ਸੁਰੱਖਿਆ ਮੁਰਗੀਆਂ ਦੇ ਰਹਿਣ ਦੇ ਸਥਾਨ ਨੂੰ ਰੋਜ਼ਾਨਾ ਸਾਫ ਕਰਨਾ ਅਤੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਕਾ ਲਵਾਉਣਾ ਬਹੁਤ ਜ਼ਰੂਰੀ ਹੈ ਪਾਰਸ ਦੇ ਕਬੂਲਣ ਯੋਗ ਹਿੱਸੇ ਮੈਂ ਮੁਰਗੀਆਂ ਦੇ ਮਾਸ ਅਤੇ ਅੰਡਿਆਂ ਨੂੰ ਬਜ਼ਾਰ ਵੇਚਣ ਲਈ ਸਹੀ ਥਾਂ 'ਤੇ ਸੰਪਰਕ ਕਰਦਾ ਹਾਂ ਵਿਕਰੀ ਅਤੇ ਮਾਰਕੀਟਿੰਗ ਮੈਂ ਆਪਣੇ ਉਤਪਦਾਂ ਦੀ ਵਿਕਰੀ ਲਈ ਸਥਾਨਕ ਮਾਰਕੀਟਾਂ ਰੈਸਟੋਰੈਂਟ ਅਤੇ ਸਿੱਧੇ ਜਾਂ ਘਰਾਂ ਸੰਪਰਕ ਕਰਦਾ ਹਾਂ ਇਸ ਦੇ ਨਾਲ ਹੀ ਸਮਾਜਿਕ ਮੀ ਮੀਡੀਆ ਦੀ ਵੀ ਵਰਤੋਂ ਕਰਦਾ ਹਾਂ ਅਤੇ ਰਿਕਾਰਡ ਰੱਖਣਾ ਮੈਂ ਹਰ ਮੁਰਗੀ ਦੀ ਸਿਹਤ ਉਤਪਾਦਕਾਂ ਅਤੇ ਵਿਕਰੀ ਦਾ ਰਿਕਾਡ ਰੱਖਦਾ ਹਾਂ ਜਿਸ ਨਾਲ ਮੈਨੂੰ ਕਾਰੋਬਾਰ ਨੂੰ ਅਗਲੇ ਪੱਧਰ 'ਤੇ ਲੈ ਜਾਣ ਵਿੱਚ ਮਦਦ ਮਿਲਦੀ ਹੈ ਇਸ ਤਰ੍ਹਾਂ ਮੈਂ ਆਪਣੀ ਪੋਲਟਰੀ ਕਾਰੋਬਾਰ ਨੂੰ ਸਮਰਥੀ ਨਾਲ ਚਲਾਉਂਦਾ ਹਾਂ ਅਤੇ ਯਕੀਨੀ ਬਣਾਉਦਾ ਹਾਂ ਕਿ ਮੇਰੇ ਜਾਨਵਰਾਂ ਦੀ ਸੰਭਾਲ ਚੰਗੀ ਤਰ੍ਹਾਂ ਹੋ ਰਹੀ ਹੈ